ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਮੈਨੂੰ ਫੋਟੋ ਖਿੱਚਣ ਦਾ ਬਹੁਤ ਸ਼ੌਂਕ ਹੈ ਫੋਟੋਆਂ ਖਿੱਚਣ ਦਾ ਮੈਨੂੰ ਬਹੁਤ ਸ਼ੌਂਕ ਹੈ ਮੈਂ ਸੋਚ ਰਿਹਾ ਹਾਂ ਕਿ ਕਿਉਂ ਨਾ ਕੋਈ ਫੋਟੋਗ੍ਰਾਫੀ ਦਾ ਕੋਰਸ ਵਗੈਰਾ ਕਰ ਲਿਆ ਜਾਵੇ ਲੋਕ ਅੱਜ ਕੱਲ੍ਹ ਵਿਆਹਾਂ ਸ਼ਾਦੀਆਂ ਵਿੱਚ ਵੀ ਫੋਟੋਆਂ ਖਿੱਚਣ ਦਾ ਬਹੁਤ ਰਿਵਾਜ਼ ਹੈ ਸ਼ੂਟ ਕਰਨ ਦਾ ਬਹੁਤ ਰਿਵਾਜ਼ ਹੈ ਜਿਸ ਤਰ੍ਹਾਂ ਕੋਈ ਪਾਰਟੀ ਵਗੈਰਾ ਹੋ ਗਈ ਫੋਟੋਗ੍ਰਾਫਰੀ ਦਾ ਫੋਟੋਆਂ ਖਿਚਾਉਣ ਦਾ ਬਹੁਤ ਸੌਂਕ ਹਨ ਪਾਰਟੀ ਵਗੈਰਾ 'ਤੇ ਬਰਡੇ ਫੰਕ ਫੰਕਸ਼ਨਾਂ 'ਤੇ ਬਹੁਤ ਅੱਜ ਤੱਕ ਫੋਟੋਗ੍ਰਾਫਰੀ ਦਾ ਟਰੈਂਡ ਬਣਿਆ ਹੋਇਆ ਹੈ ਮੈਂ ਸੋਚ ਰਿਹਾ ਹਾਂ ਕਿਉਂ ਨਾ ਫੋਟੋਗ੍ਰਾਫਰੀ ਦਾ ਕਿੱਤਾ ਅਪਣਾ ਲਿਆ ਜਾਵੇ ਜੋ ਕਿ ਅੱਜ ਕੱਲ੍ਹ ਫੋਟੋਆਂ ਖਿੱਚਣ ਦੇ ਬਹੁਤ ਲੋਕ ਪਸੰਦ ਕਰਦੇ ਹਨ ਵਿਆਹ ਸ਼ਾਦੀਆਂ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਕਿ ਸ਼ੂਟ ਬਹੁਤ ਕਰਵਾਉਂਦੇ ਹਨ ਜਿਸ ਤਰ੍ਹਾਂ ਕੋਈ ਜਨਮ ਦਿਨ ਪਾਰਟੀ ਵਗੈਰਾ ਹੋ ਗਈ ਉੱਥੇ ਵੀ ਬਹੁਤ ਲੋਕ ਫੋਟੋਆਂ ਖਿਚਾਉਂਦੇ ਫਿਰਦੇ ਹਨ ਜਿਸ ਤਰ੍ਹਾਂ ਕੋਈ ਵੀ ਹੋਰ ਫੰਕਸ਼ਨ ਲਗਾ ਲਓ ਜਾਗਰਣ ਵਗੈਰਾ ਹੋ ਗਈ ਕਿੱਟੀ ਪਾਰਟੀ ਵਗੈਰਾ ਹੋ ਗਈ ਕਿਤੇ ਵੀ ਉਹ ਮੈ ਮੈਂ ਵੀ ਆਪਣੇ ਫੋਟੋਗ੍ਰਾਫਰੀ ਬਾਰੇ ਵੀ ਕੋਈ ਕਿੱਤਾ ਬਣਾ ਲੀਏ ਨਾਲੇ ਫੋਟੋਗ੍ਰਾਫਰੀ ਪੈਸੇ ਸ ਬ ਬਚਣਗੇ ਜੋ ਕਿ ਅਤੇ ਨਾਲੇ ਮੇਰਾ ਕਿੱਤਾ ਬਣ ਜਾਵੇਗਾ ਜੋ ਕਿ ਬਹੁਤ ਫਾਇਦਾ ਹੋਏਗਾ ਫੋਟੋਗ੍ਰਾਫਰੀ ਦਾ ਹੁਣ ਅੱਜ ਕੱਲ੍ਹ ਟਰੈਂਡ ਚੱਲਿਆ ਹੋਇਆ ਇੱਕ ਤਰ੍ਹਾਂ ਦਾ ਬਹੁਤ ਹੀ